ਪੰਜਾਬ ਦਾ ਸੱਭਿਆਚਾਰ ਬਹੁਤ ਹੀ ਅਲੱਗ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਪਹਿਰਾਵੇ ਦੇ ਰੂਪ ਦੇ ਵਿੱਚ ਕੁੜਤਾ ਪਜਾਮਾ ਮਰਦਾਂ ਦੁਆਰਾ ਅਤੇ ਔਰਤਾਂ ਦੁਆਰਾ ਸਲਵਾਰ ਸੂਟ ਪਹਿਨਿਆ ਜਾਂਦਾ ਹੈ ਜਦੋਂ ਆਪਾਂ ਪੰਜਾਬ ਦੇ ਵਿੱਚ ਆਉਂਦੇ ਹਾਂ ਤਾਂ ਸਾਨੂੰ ਕੁੜਤਾ ਪਜਾਮਾ ਅਤੇ ਸਲਵਾਰ ਸੂਟ ਲੋਕਾਂ ਦੇ ਪਾਇਆ ਆਮ ਹੀ ਦਿੱਖ ਜਾਵੇਗਾ ਇਹ ਸਮੱਗਰੀਆਂ ਪੰਜਾਬ ਦੇ ਸੱਭਿਆਚਾਰ ਨੂੰ ਪ੍ਰਗਟਾਉਂਦੀਆਂ ਹਨ ਅਤੇ ਕੁਝ ਕੁ ਕਲਾਵਾਂ ਜਿਵੇਂ ਕਿ ਗੱਤਕਾ ਦੀ ਕਲਾ ਜਿਹੜੀ ਕਿ ਕਿਸੇ ਹੋਰ ਖੇਤਰ ਦੇ ਵਿੱਚ ਨਹੀਂ ਪਾਈ ਜਾਂਦੀ ਜਿਹੜੀ ਕਿ ਇੱਕ ਯੁੱਧ ਕਲਾ ਨੂੰ ਲੈ ਕੇ ਪ੍ਰਸਿੱਧ ਹੋਈ ਹੈ ਗੱਤਕਾ ਦੀ ਕਲਾ ਵੀ ਪੰਜਾਬ ਦੇ ਸੱਭਿਆਚਾਰ ਨੂੰ ਪ੍ਰਗਟਾਉਂਦੀ ਹੈ ਕਿਉਂਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੱਤਕਾ ਗੱਤਕਾ ਨੂੰ ਇੱਕ ਖੇਡ ਦੇ ਰੂਪ ਦੇ ਵਿੱਚ ਪ੍ਰਗਟ ਕੀਤਾ ਜਿਹਦੇ ਵਿੱਚ ਉਹਨਾਂ ਨੇ ਯੁੱਧ ਕਲਾ ਨੂੰ ਲੈ ਕੇ ਇਸ ਦੇ ਉੱਤੇ ਧਿਆਨ ਦਿੱਤਾ ਗਿਆ ਅਤੇ ਉਸ ਤਰ੍ਹਾਂ ਹੀ ਹੋਰ ਵੀ ਬਹੁਤ ਸਾਰੀਆਂ ਕਲਾਵਾਂ ਹਨ ਜਿਹੜੀਆਂ ਕਿ ਪੰਜਾਬ ਨੂੰ ਪੰਜਾਬ ਦੇ ਸੱਭਿਆਚਾਰ ਨੂੰ ਪ੍ਰਗਟਾਉਂਦੀਆਂ ਹਨ